ਮੇਰੀ ਜ਼ਿੰਦਗੀ ਵਿੱਚ ਅਜਿਹੀਆਂ ਗਲਤੀਆਂ ਬਹੁਤ ਹੀ ਘੱਟ ਹੋਈਆਂ ਹਨ ਜਿਹੜੀ ਕਿ ਮੈਨੂੰ ਯਾਦ ਹੈ ਇੱਕ ਵਾਰ ਮੈਂ ਆਪਣੀ ਮਾਤਾ ਜੀ ਨਾਲ ਸਬਜ਼ੀ ਬਣਾ ਰਹੀ ਸੀ ਅਤੇ ਮੈਂ ਕੁੱਕਰ ਦੀ ਸੀਟੀ ਲਗਾਉਣਾ ਭੁੱਲ ਗਈ ਸੀ ਜਿਸ ਕਾਰਨ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਬਣਦਾ ਬਣਦਾ ਫ ਕੂਕਰ ਫਟਣ ਫਟ ਗਿਆ ਸੀ ਅਤੇ ਜਿਸ ਨਾਲ ਸਾਡੀ ਰਸੋਈ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਅਤੇ ਸ ਸਾਰੇ ਘਰ ਦੇ ਮੈਂਬਰਾਂ ਦਾ ਦਿਲ ਵੀ ਦਹਿਲ ਉੱਠਿਆ ਸੀ ਕਿ ਤਾਂ ਰੱਬ ਦੀ ਦਇਆ ਨਾਲ ਸ਼ੁਕਰ ਰੱਬ ਦੇ ਸ਼ੁਕਰ ਗੁਜ਼ਾਰ ਹਾਂ ਕਿ ਸਾਡਾ ਐਡਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਜਿਸ ਨਾਲ ਪਰ ਸਾਡੀ ਰਸੋਈ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਜਿਸ ਨਾਲ ਇਹ ਘਟਨਾ ਮੈਨੂੰ ਬਹੁਤ ਹੀ ਜ਼ਿਆਦਾ ਯਾਦ ਹੈ ਇਸ ਤੋਂ ਬਾਅਦ ਮੈਂ ਅੱਗੇ ਤੋਂ ਇਹੇ ਜਿਹੀ ਗਲਤੀ ਕਦੇ ਵੀ ਨਹੀਂ ਕੀਤੀ